ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਦਸਵੇਂ ਗੁਰੂ ਹਨ ਉਨ੍ਹਾਂ ਨੇ ਵਿਸਾਖੀ ਵਾਲੇ ਦਿਨ ਸੌਲ੍ਹਾਂ ਸੌ ਨੜਿਨਵੇਂ ਈਸਵੀ ਦੇ ਵਿੱਚ ਅਨੰਦਪੁਰ ਸਾਹਿਬ ਵਿੱਚ ਖਾਲਸਾ ਪੰਥ ਦੀ ਸਥਾਪਨਾ ਕੀਤੀ ਖਾਲਸਾ ਪੰਥ ਦੀ ਸਥਾਪਨਾ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਸੀਸਾਂ ਦੀ ਮੰਗ ਕੀਤੀ ਭਾਈ ਦਇਆ ਰਾਮ ਭਾਈ ਸਾਹਿਬ ਦਾਸ ਅ ਭਾਈ ਮੋਹਕਮ ਚੰਦ ਭਾਈ ਹਿੰਮਤ ਰਾਏ ਅਤੇ ਭਾਈ ਸਾਹਿਬ ਚੰਦ ਪੰਜ ਜਣਿਆ ਨੇ ਆਪਣੇ ਸੀਸ ਗੁਰੂ ਜੀ ਨੂੰ ਭੇਂਟ ਕੀਤੇ ਗੁਰੂ ਜੀ ਨੇ ਉਨ੍ਹਾਂ ਨੂੰ ਖੰਡੇ ਬਾਟੇ ਦੀ ਪਾਹੁਲ ਦਾ ਅੰਮ੍ਰਿਤ ਛਕਾਇਆ ਅਤੇ ਉਨ੍ਹਾਂ ਦੇ ਨਾਮ ਪਿੱਛੇ ਸਿੰਘ ਲਗਾਇਆ ਅਤੇ ਉਨ੍ਹਾਂ ਨੂੰ ਪੰਜ ਕਕਾਰ ਪ੍ਰਦਾਨ ਕੀਤੇ ਕੇਸ ਕੰਘਾ ਕੜਾ ਕਿਰਪਾਨ ਅਤੇ ਕਛਿਹਰਾ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਤੋਂ ਖੁਦ ਅੰਮ੍ਰਿਤ ਛਕਿਆ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਖਾਲਸਾ ਪੰਥ ਦੀ ਸਥਾਪਨਾ ਨੇ ਗੁਰੂ ਗੋਬਿੰਦ ਸਿੰਘ ਜੀ ਅੱਗੇ ਬਹੁਤ ਸਾਰੇ ਉਦੇਸ਼ ਸਨ ਉਨ੍ਹਾਂ ਲਈ ਸਭ ਤੋਂ ਵੱਡਾ ਉਦੇਸ਼ ਇਹ ਸੀ ਕਿ ਸਿੱਖਾਂ ਨੂੰ ਨਿਡਰ ਬਣਾਇਆ ਜਾਵੇ ਇਸ ਉਦੇਸ਼ ਲਈ ਉਨ੍ਹਾਂ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਅਤੇ ਉਨ੍ਹਾਂ ਨੂੰ ਪੰਜ ਕਕਾਰ ਪ੍ਰਦਾਨ ਕੀਤੇ ਤਾਂ ਜੋ ਉਹ ਕਿਰਪਾਨ ਦੇ ਨਾਲ ਆਪਣੀ ਹਿਫਾਜ਼ਤ ਖੁਦ ਕਰਨ ਫੇਰ ਉਨ੍ਹਾਂ ਦੇ ਸਾਹਮਣੇ ਉਦੇਸ਼ ਸੀ ਕਿ ਉਨ ਉਨ੍ਹਾਂ ਦੀ ਕੌਮ ਦਾ ਇੱਕ ਵੱਖਰਾ ਰੂਪ ਰੰਗ ਹੋਣਾ ਚਾਹੀਦਾ ਹੈ ਜਿਹੜਾ ਕਿ ਸਹਿਜੇ ਹੀ ਪਛਾਣਿਆ ਜਾ ਸਕੇ ਅਤੇ ਉਹ ਮੁਗਲਾਂ ਨਾਲੋਂ ਵੱਖਰੇ ਹੋਣ ਤਾਂ ਜੋ ਗੁਰੂ ਗੋਬਿੰਦ ਸਿੰਘ ਜੀ ਅਤੇ ਹੋਰ ਸਿੱਖ ਨੇ ਜਿਹੜੇ ਉਹ ਆਪਣੇ ਦੁਸ਼ਮਣ ਅਤੇ ਆਪਣੇ ਸਾਥੀ ਵਿੱਚ ਪਹਿਚਾਣ ਕਰ ਸਕਣ ਇਸ ਲਈ ਸਿੱਖਾਂ ਲਈ ਕੇਸ ਰੱਖਣੇ ਬਹੁਤ ਜ਼ਰੂਰੀ ਹੈ ਦਾੜ੍ਹੀ ਅਤੇ ਸਿਰ ਦੇ ਵਾਲ ਅਤੇ ਸਿਰ 'ਤੇ ਪੱਗੜੀ ਪੱਗ ਬੰਨਣੀ ਬਹੁਤ ਜ਼ਰੂਰੀ ਹੈ ਤਾਂ ਜੋ ਜਿਹੜਾ ਸਿੱਖ ਹੈ ਉਹ ਸਹਿਜੇ ਹੀ ਪਛਾਣਿਆ ਜਾ ਸਕੇ ਅਤੇ ਗੁਰੂ ਗੋਬਿੰਦ ਸਿੰਘ ਜੀ ਅੱਗੇ ਉਸ ਸਮੇਂ ਦੇ ਹਕੂਮਤ ਨਾਲ ਲੜਨ ਲਈ ਅਤੇ ਸਿੱਖਾਂ ਨੂੰ ਨਿਡਰ ਬਣਾਉਣ ਲਈ ਖਾਲਸਾ ਪੰਥ ਦੀ ਸਥਾਪਨਾ ਕਰਨਾ ਸਭ ਤੋਂ ਵੱਡਾ ਉਨ੍ਹਾਂ ਦਾ ਇੱਕ ਉਦੇਸ਼ ਸੀ ਫਿਰ ਜਦੋਂ ਖਾਲਸਾ ਪੰਥ ਦੀ ਸਥਾਪਨਾ ਹੋਈ ਤਾਂ ਜਿਹੜੇ ਸਿੱਖ ਸੀ ਉਸ ਤੋਂ ਬਾਅਦ ਉਨ੍ਹਾਂ ਦਾ ਇੱਕ ਵੱਖਰਾ ਹੀ ਰੂਪ ਵੇਖਣ ਨੂੰ ਮਿਲਿਆ ਜਿਹੜੇ ਕਿ ਉਹ ਬਹੁਤ ਨਿਡਰ ਹੋ ਗਏ ਅਤੇ ਉਸ ਤੋਂ ਉਨ੍ਹਾਂ ਨੇ ਬਹੁਤ ਸਾਰੀਆਂ ਲੜਾਈਆਂ ਕੀਤੀਆਂ ਅਤੇ ਮੁਗਲਾਂ ਨੂੰ ਭਾਰਤ ਦੇਸ਼ ਤੋਂ ਬਾਹਰ ਕੱਢਿਆ ਤਾਂ ਇਹ ਤੁਸੀਂ ਖੁਦ ਹੀ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਖਾਲਸਾ ਪੰਥ ਦੀ ਸਥਾਪਨਾ ਦੇ ਨਾਲ ਜਿਹੜੇ ਸਿੱਖ ਹੈ ਉਹ ਇੱਕ ਮੁੱਠ ਹੋ ਗਏ ਉਹ ਇੱਕ ਜੁੱਟ ਹੋ ਗਏ ਜਿੰਨੇ ਸਿੱਖ ਸੀ ਉਹ ਸਾਰੇ ਇੱਕ ਪਾਸੇ ਹੋ ਗਏ ਉਹਨਾਂ ਦੀ ਇੱਕ ਵੱਖ ਪਹਿਚਾਣ ਬਣ ਗਈ ਤਾਂ ਖਾਲਸਾ ਪੰਥ ਦੀ ਜਿਹੜੀ ਸਥਾਪਨਾ ਹੈ ਉਹਦੇ ਕਈ ਉਦੇਸ਼ ਸੀ ਜਿਹੜੇ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਮਣੇ ਸਨ ਅਤੇ ਉਹ ਕਰਨਾ ਚਾਹੁੰਦੇ ਸਨ ਪੂਰਾ ਉਨ੍ਹਾਂ ਨੂੰ ਖਾਲਸਾ ਪੰਥ ਦੀ ਸਥਾਪਨਾ ਦੇ ਨਾਲ ਸਿੱਖ ਕੌਮ ਨੂੰ ਸਿੱਖ ਕੌਮ ਲਈ ਬਹੁਤ ਵਧੀਆ ਸੀ ਖਾਲਸਾ ਪੰਥ ਦੀ ਸਥਾਪਨਾ ਹੋਣਾ ਇਸ ਦੇ ਨਾਲ ਸਿੱਖ ਕੌਮ ਪੂਰੀ ਤਰ੍ਹਾਂ ਬਦਲ ਗਈ ਪਹਿਲਾਂ ਖਾਲਸਾ ਪੰਥ ਦੀ ਸਥਾਪਨਾ ਤੋਂ ਪਹਿਲਾਂ ਜਿੱਥੇ ਕਈ ਸਿੱਖ ਸੀ ਜਿਹੜੇ ਉਨ੍ਹਾਂ ਦੀ ਪਹਿਚਾਣ ਨਹੀਂ ਸੀ ਜਾਂ ਕਈ ਸਿੱਖ ਸੀ ਉਹ ਉਨ੍ਹਾਂ ਦਾ ਪਤਾ ਨਹੀਂ ਸੀ ਲੱਗਦਾ ਕਿ ਸ਼ਾਇਦ ਕੋਈ ਹੋਰ ਹੋਵੇ ਤਾਂ ਉਹ ਸਿੱਖ ਬਣ ਕੇ ਅਪ ਕਿਸੇ ਅੰਦਰ ਖਾਤ ਕੋਈ ਭੇਤ ਦੇ ਰਿਹਾ ਹੋਵੇ ਤਾਂ ਖਾਲਸਾ ਪੰਥ ਦੀ ਸਥਾਪਨਾ ਨਾਲ ਸਾਰੇ ਸਿੱਖਾਂ ਨੇ ਅੰਮ੍ਰਿਤ ਛੱਕ ਲਿਆ ਉਨ੍ਹਾਂ ਦੀ ਇੱਕ ਪਹਿਚਾਣ ਬਣ ਗਈ ਅਤੇ ਜਿਹੜਾ ਵੀ ਕੋਈ ਸਿੱਖ ਅੰਮ੍ਰਿਤ ਛੱਕਦਾ ਸੀ ਤਾਂ ਉਹਦੇ ਲਈ ਕੇਸ ਕੰਘਾ ਕੜਾ ਕਿਰਪਾਨ ਕਛਹਿਰਾ ਇਹ ਸਾਰੇ ਕਕਾਰ ਬਹੁਤ ਜ਼ਰੂਰੀ ਸੀ ਤਾਂ ਇਹਦੇ ਨਾਲ ਸਹਿਜੇ ਪਛਾਣਿਆ ਜਾਏ ਜਾਣ ਲੱਗਾ ਕਿ ਇਹ ਸਿੱਖ ਆ ਜਾਂ ਫਿਰ ਨਹੀਂ ਹੈਗਾ ਫਿਰ ਉਸ ਤੋਂ ਬਾਅਦ ਸਿੱਖਾਂ ਲਈ ਆਪਦਾ ਚਰਿੱਤਰ ਬਹੁਤ ਵੱਡੀ ਗੱਲ ਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਪੂਰਾ ਉਪਦੇਸ਼ ਦਿੱਤਾ ਸੀ ਕਿ ਜਿਹੜੇ ਸਿੱਖ ਨੇ ਉਨ ਉਨ੍ਹਾਂ ਚਰਿੱਤਰਹੀਣ ਨਹੀਂ ਹੋਣਾ ਚਾਹੀਦੇ ਉਨ੍ਹਾਂ ਦਾ ਚਰਿੱਤਰ ਬਹੁਤ ਉੱਚਾ ਹੋਣਾ ਚਾਈਦਾ ਤਾਂ ਸਿੱਖਾਂ ਦਾ ਚਰਿੱਤਰ ਬਹੁਤ ਉੱਚਾ ਅੱਜ ਵੀ ਜੇਕਰ ਆਪਾਂ ਵੇਖੀਏ ਤਾਂ ਕੋਈ ਵੀ ਇਨਸਾਨ ਉਹ ਪੱਗ ਵਾਲੇ ਬੰਦੇ 'ਤੇ ਯ ਛੇਤੀ ਵਿਸ਼ਵਾਸ ਕਰਦਾ ਹੈ ਦੂਸਰੇ ਬੰਦੇ ਨਾਲੋਂ ਤਾਂ ਇਹ ਵੀ ਇੱਕ ਖਾਲਸਾ ਪੰਥ ਦੀ ਸਥਾਪਨਾ ਹੋਣ ਨਾਲ ਹੀ ਸਾਨੂੰ ਇੰਨਾਂ ਵੱਡਾ ਜਿਹੜਾ ਮਾਨ ਆ ਉਹ ਮਿਲਿਆ ਹੈ ਸਿੱਖ ਪੰ ਖਾਲਸਾ ਪੰਥ ਦੀ ਸਥਾਪਨਾ ਹੋਣ ਨਾਲ ਸਿੱਖ ਕੌਮ ਹੈ ਜਿਹੜੀ ਜਾਂ ਸਿੱਖ ਧਰਮ ਹੈ ਉਹਦੀ ਬਹੁਤ ਪ੍ਰਫੁੱਲਤਾ ਹੋਈ ਅਤੇ ਅੱਜ ਤੱਕ ਹੁਣ ਤੱਕ ਸਿੱਖ ਧਰਮ ਹੈ ਜਿਹੜਾ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਿਹਾ ਹੈ ਚਲ ਰਿਹਾ ਹੈ ਤਾਂ ਉਹ ਸਾਰੀ ਖਾਲਸਾ ਪੰਥ ਦੀ ਸਥਾਪਨਾ ਦੇ ਕਰਕੇ ਹੋਈ ਫੇਰ ਖਾਲਸਾ ਪੰਥ ਦੀ ਸਥਾਪਨਾ ਦੇ ਨਾਲ ਜਿਹੜੇ ਮੁਗਲ ਹੈ ਉਹ ਆਪਣੇ ਦੇਸ਼ ਤੋਂ ਬਾਹਰ ਹੋ ਗਏ ਅਤੇ ਇਹ ਵੀ ਬਹੁਤ ਵੱਡੀ ਗੱਲ ਹੈ ਅਤੇ ਸਿੱਖਾਂ ਨੇ ਜਿੰਨੀਆਂ ਵੀ ਕੁਰਬਾਨੀਆਂ ਕੀਤੀਆਂ ਉਹ ਸਾਰੀਆਂ ਇਤਿਹਾਸ ਦੇ ਵਿੱਚ ਪਤਾ ਹੀ ਹੈ ਅਜ਼ਾਦੀ ਵੇਲੇ ਵੀ ਕੁਰਬਾਨੀਆਂ ਦਿੱਤੀਆਂ ਅਤੇ ਇਹ ਸਾਰਾ ਕੁਛ ਖਾਲਸਾ ਪੰਥ ਦੀ ਸਥਾਪਨਾ ਕਰਕੇ ਹੀ ਹੋ ਸਕਿਆ ਹੈ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਬਹੁਤ ਵੱਡੀ ਦੇਣ ਆ ਆਪਾਂ ਨੂੰ